ਟਰੇਲ ਰਨਿੰਗ ਅਤੇ ਸਪਰਿੰਟ ਅੰਤਰਾਲ ਕਰਨ ਨਾਲ ਮੇਰਾ ਫੈਟ ਰਿਡਿਊਸ ਹੋਇਆ ਬਹੁਤ ਘਾਟ ਹੋਈ ਅਤੇ ਮੇਰੇ ਸਰੀਰ ਦੇ ਵਿੱਚ ਮਸਲ ਵਧਿਆ ਮੇਰਾ ਸਟੈਮਿਨਾ ਵੀ ਇਨਕ੍ਰੀਜ ਹੋਇਆ ਅਤੇ ਮੇਰੇ ਰੋਜ਼ ਦੇ ਸ਼ੇਡਿਊਲ 'ਚ ਥੋੜ੍ਹਾ ਡਿਸਿਪਲਿਨ ਆਇਆ ਕਿਉਂਕਿ ਮੈਂ ਰੋਜ਼ ਸੁਬਹ ਜਲਦੀ ਉੱਠ ਕੇ ਟਰੇਲ ਰਨਿੰਗ ਕਰਨ ਜਾਂਦਾ ਸੀ ਅਤੇ ਸ਼ਾਮ ਜਦੋਂ ਮੈਂ ਆਫਿਸ ਤੋਂ ਵਾਪਿਸ ਆਉਂਦਾ ਸੀ ਤਾਂ ਸੁਪਰਿੰਟ ਅੰਤਰਾਲ ਕਰਦਾ ਸੀ ਤਾਂ ਇਹ ਐਕਟੀਵਿਟੀਜ ਕਰਨ ਨਾਲ ਮੇਰੀ ਬਾਡੀ ਵੀ ਵਧੀਆ ਹੋਈ ਮੇਰੇ ਸਟੈਮਿਨਾ ਵੀ ਇਨਕਰੀਜ ਹੋਇਆ ਅਤੇ ਮੇਰੀ ਦਿਨ ਦੇ ਟਾਈਮ ਟੇਬਲ 'ਚ ਥੋੜ੍ਹਾ ਡਿਸਿਪਲੀਨ ਵੀ ਆਇਆ ਅਤੇ ਮੇਰੀ ਟਰੇਲ ਰਨਿੰਗ ਕਰਨ ਨਾਲ ਮੈਂ ਡਰੈਕਸ ਕਰਨ ਦਾ ਥੋੜ੍ਹਾ ਸ਼ੌਕੀਨ ਹੋਇਆ ਅਤੇ ਸਪਰਿੰਟ ਅੰਤਰਾਲ ਕਰਨ ਨਾਲ ਮੇਰੀ ਸਪੀਡ ਵੀ ਥੋੜ੍ਹੀ ਵੱਧ ਗਈ ਅਤੇ ਮੈਂ ਥੋੜ੍ਹਾ ਜੰਪ ਵੀ ਜ਼ਿਆਦਾ ਉੱਚਾ ਕਰਨ ਲੱਗ ਗਿਆ ਜਿਹਦੇ ਕਾਰਨ ਮੈਂ ਥੋੜ੍ਹਾ ਸਪੋਰਟਸ ਦੇ ਵਿੱਚ ਵੀ ਵਧੀਆ ਹੋਇਆ